ਮੇਰੀ ਮਨਪਸੰਦ ਕਿਤਾਬ ਫਾਸਲੇ ਹੈ ਜੋ ਕਿ ਜਤਿੰਦਰ ਬਰਾੜ ਜੀ ਦੁਆਰਾ ਲਿਖੀ ਗਈ ਹੈ ਜਤਿੰਦਰ ਬਰਾੜ ਜੀ ਇਸ ਫਾਸਲੇ ਕਿਤਾਬ ਰਾਹੀਂ ਸਾਨੂੰ ਇੱਕ ਨਾਟਕ ਪੇਸ਼ ਕਰਨਾ ਚਾਹੁੰਦੇ ਹਨ ਜਿਹਨਾਂ ਵਿੱਚ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੀ ਤਕਲੀਫਾਂ ਅਤੇ ਸਾਡੀ ਜ਼ਿੰਦਗੀ ਦੇ ਵੱਧ ਰਹੇ ਫਾਸਲਿਆਂ ਬਾਰੇ ਦੱਸਿਆਂ ਗਿਆ ਹੈ ਅਮੀਰੀ ਗਰੀਬੀ ਦਾ ਫਾਸਲਾ ਤਰੱਕੀ ਦੁਆਰਾ ਵੱਧ ਰਹੇ ਸ਼ਿਕਸ਼ਾ ਦੇ ਫਾਸਲੇ ਵੀ ਸਾਨੂੰ ਇਸ ਵਿੱਚ ਦੇਖਣ ਨੂੰ ਮਿਲਦੇ ਹਨ ਜਾਤ ਪਾਤ ਦੇ ਫਾਸਲੇ ਊਚ ਨੀਚ ਦੇ ਫਾਸਲੇ ਫਾਸਲੇ ਮਜ੍ਹਬ ਦੇ ਫਾਸਲੇ ਅਤੇ ਹੋਰ ਵੀ ਕਈ ਖਤਰਨਾਕ ਫਾਸਲੇ ਸਾਨੂੰ ਇਸ ਵਿੱਚ ਦੇਖਣ ਨੂੰ ਮਿਲਦੇ ਹਨ ਇਸ ਵਿੱਚ ਨੂਰੀ ਡੋਕਟਰ ਕੰਪਾਉਂਡਰ ਡੋਲੀ ਆਦਿ ਕਰ ਕਿਰਦਾਰ ਪੇਸ਼ ਕੀਤੇ ਗਏ ਹਨ ਜਿਹਨਾਂ ਵਿੱਚ ਡੋਲੀ ਨੂੰ ਡੋਲੀ ਨੂੰ ਡੋਕਟਰ ਦੀ ਪਤਨੀ ਬਣਾਇਆ ਗਿਆ ਹੈ ਅਤੇ ਨੂਰੀ ਨੂੰ ਬਹੁਤ ਹੀ ਸ ਗਰੀਬ ਅਤੇ ਸੂਝਵਾਨ ਸਮ ਦੱਸਿਆ ਗਿਆ ਹੈ